ਮੈਂ ਪੇਸ਼ੇ ਵਜੋਂ ਇੱਕ ਕੋਲਜ ਦੇ ਵਿੱਚ ਪ੍ਰੋਫੈਸਰ ਹਾਂ ਜਿਸ ਤੋਂ ਮੇਰੀ ਰੋਜ਼ੀ ਰੋਟੀ ਦਾ ਸਾਧਨ ਆਉਂਦਾ ਹੈ ਮੈਂ ਮੇਰੇ ਕਰੀਅਰ ਨੂੰ ਬਹੁਤ ਪਸੰਦ ਕਰਦਾ ਹਾਂ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇੱਕ ਇੰਜੀਨੀਅਰ ਬਣਾ ਅਤੇ ਉਸੇ ਹੀ ਫੀਲਡ ਦੇ ਵਿੱਚ ਹੋਰ ਬੱਚਿਆਂ ਨੂੰ ਵੀ ਪੜ੍ਹਾਵਾਂ ਅਤੇ ਜਿਸ ਦੇ ਲਈ ਮੈਂ ਆਪਣੇ ਜੀਵਨ ਦੇ ਵਿੱਚ ਸਫ਼ਲ ਵੀ ਰਿਹਾ ਹਾਂ ਮੇਰਾ ਸ਼ੁਰੂ ਤੋਂ ਹੀ ਇਹ ਮਕਸਦ ਅਤੇ ਟੀਚਾ ਸੀ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ ਮੈਂ ਹਮੇਸ਼ਾ ਹੀ ਸਕੂਲ ਦੇ ਵਿੱਚ ਮੇਰੇ ਟੀਚਰਾਂ ਨੂੰ ਮੇਰੇ ਨਾਲ ਵਾਲੇ ਸਾਥੀਆਂ ਨੂੰ ਦੱਸਿਆ ਕਰਦਾ ਸੀ ਕਿ ਮੈਂ ਵੱਡਾ ਹੋ ਕੇ ਇੰਜੀਨੀਅਰ ਬਣਾਂਗਾ ਅਤੇ ਫਿਰ ਉਸ ਦਾ ਪ੍ਰੋਫੈਸਰ ਲੱਗਾਂਗਾ ਸੋ ਉਸੇ ਲਈ ਮੈਂ ਉਦੋਂ ਤੋਂ ਹੀ ਪ੍ਰੋਫੈਸਰ ਅਤੇ ਇੰਜੀਨੀਅਰ ਬਣਨ ਦੇ ਲਈ ਮਿਹਨਤ ਕਰਦਾ ਰਿਹਾ ਅਤੇ ਅੰਤ ਦੇ ਵਿੱਚ ਮੈਨੇ ਆਪਣਾ ਇਹ ਮੁਕਾਮ ਹਾਸਿਲ ਕਰ ਲਿਆ ਮੈਂ ਆਪਣੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ